ਹਾਂਜੀ ਸਤਿ ਸ਼੍ਰੀ ਸ਼ਾ ਹਾਂਜੀ ਹਾਂਜੀ ਭਾਅ ਜੀ ਕਿਵੇਂ ਹੋ ਭਾਅ ਜੀ ਹਾਂ ਵਧੀਆ ਵਧੀਆ ਹੋਰ ਤੁਸੀਂ ਆਉਂਦੇ ਨਹੀਂ ਅੱਜ ਕੱਲ੍ਹ ਭਾਅ ਜੀ ਯਾਰ ਅੱਛਾ ਅੱਛਾ ਅੱਛਾ

ਹਾਂਜੀ ਹਾਂਜੀ ਭਾਅ ਜੀ ਬਰਫੀ ਦਾ ਚਲਦਾ ਸਾਢੇ ਤਿੰਨ ਸੌ ਰੁਪਏ ਕਿੱਲੋ ਚਲਦੀ ਭਾਅ ਜੀ ਯਾਰ ਗੁਲਾਬ ਜਾਮੁਨਾਂ ਭਾਅ ਜੀ ਢਾਈ ਸੌ

ਸਮੋਸੇ ਭਾਅ ਜੀ ਉੱਦਾਂ ਤਾਂ ਭਾਅ ਜੀ ਯਾਰ ਅਸੀਂ ਉਹ ਤਾਂ ਚਾਹੀਦਾ ਚਲੋ ਭਾਅ ਜੀ ਉੱਦਾਂ ਤਾਂ ਅਸੀਂ ਲਾ ਦਿੰਦੇ ਆ ਪੰਦਰਾ ਬਾਕੀਆਂ ਨੂੰ ਤੁਹਾਨੂੰ ਗ੍ਰਾਹਕ ਪੁਰਾਣੇ ਕਸਟਮਰ ਆ ਤੁਹਾਨੂੰ ਬਾਰਾਂ ਤੇਰਾਂ ਬਾਰਾ ਅਤੇ ਦਸ ਦਾ ਲਗਾ ਦੇਵਾਂਗਾ ਜੀ ਅੱਛਾ ਹਾਂਜੀ ਡਿਸਕਾਊਂਟ ਕਰ ਦੇਵਾਂਗੇ ਕੀ

ਹਾਂਜੀ ਹੋਰ ਹਾਂਜੀ ਕਿਹੜਾ ਭਾਅ ਜੀ ਸਮਬ੍ਰੈੱਡ ਪਕੌੜੇ ਪਕੌੜਿਆਂ ਦਾ ਭਾਅ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹਨਾਂ ਦਾ ਇਹਨਾਂ ਇਹਨਾਂ ਦਾ ਪ੍ਰਾਈਜ਼ ਤਾਂ ਭਾਅ ਜੀ ਯਾਰ ਦੇਖੋ ਜੇ ਤਾਂ ਤੁਸੀਂ ਸੋ ਬੰਦੇ ਦਾ ਪ੍ਰੋਗਰਾਮ ਕਰਨਾ ਤਾਂ ਉਸ ਹਿਸਾਬ ਨਾਲ ਇਹਦਾ ਕਿੱਲੋਆਂ ਦੇ ਹਿਸਾਬ ਨਾਲ ਲੱਗਣੀ ਭਾਅ ਜੀ ਤਾਂ ਤੁਸੀਂ ਇਹ ਦੱਸੋ ਵੀਰ ਤੁਹਾਨੂੰ ਕਿੰਨਾ ਕੁ ਬਜਟ ਹੈ ਤੁਹਾਡਾ ਭਾਅ ਜੀ ਉਸ ਹਿਸਾਬ ਨਾਲ ਤੁਹਾਨੂੰ ਫਿਰ ਪ੍ਰਾਈਜ਼ ਸੈਟ ਕਰ ਦੇਵਾਂਗੇ ਅਰੇਂਜਮੈਂਟ ਹੈਗਾ ਅੱਛਾ ਹਾਲ 'ਚ ਕਰਨੀ ਨੀਚੇ ਹਾਂਜੀ ਹਾ ਹਾਲ ਦਾ ਭਾਅ ਜੀ ਕਿੰਨੀ ਤਰੀਕ ਨੂੰ ਚਾਹੀਦਾ ਉੱਦਾਂ ਅਰੇਂਜਮੈਂਟ

ਅੱਛਾ ਠੀਕ ਜੀ ਅਗਲੇ ਹਫਤੇ ਤਰੀਕ ਕਿੰਨੀ ਅਗਲੇ ਹਫਤੇ ਕਿੰਨੀ ਵੀਹ ਦੇ ਵਿੱਚ ਵੀਹ ਤਰੀਕ ਨੂੰ ਵੀਹ ਨੂੰ ਕਿੰਨੀ ਨੂੰ ਠੀਕ ਠੀਕ ਹੈ ਭਾਅ ਜੀ ਛੇ ਛੇ ਤਰੀਕ ਨੂੰ ਭਾਅ ਜੀ ਠੀਕ ਹੈ ਉੱਦਣ ਤਾਂ ਫਰੀ ਆ ਹੋਲ ਕੋਈ ਨਹੀਂ ਤੁਸੀਂ ਹਾਂਜੀ ਹਾਂਜੀ ਠੀਕ ਹੈ ਭਾਅ ਜੀ ਅਰੇਂਜਮੈਂਟ ਅਰੇਂਜਮੈਂਟ ਚਾਹੀਦੀ ਪਾਰਟੀ ਕਰਨੀ ਠੀਕ ਹੈ ਭਾਅ ਜੀ ਕੋਈ ਨਹੀਂ ਨਾ ਨਾ ਓਕੇ ਭਾਅ ਜੀ ਕਰ ਦਮਾ ਨਾ ਨਾ ਓ ਓਕੇ ਕਰ ਦੇਵਾਂਗੇ ਭਾਅ ਜੀ ਤੁਸੀਂ ਟੈਂਸ਼ਨ ਨਾ ਲਓ ਸਮਾਨ ਸਾਰਾ ਸਾਡਾ ਇੱਕ ਨੰਬਰ ਸਾਡਾ ਪ੍ਰਾਈਜ਼ ਭਾਅ ਜੀ ਸਾਡਾ ਨੀਚੇ ਹੋਲ ਦਾ ਪੰਜਾਹ ਹਜ਼ਾਰ ਚੱਲਦਾ ਭਾਅ ਜੀ ਤੁਹਾਨੂੰ ਡਿਸਕਾਊਂਟ ਕਰਕੇ ਚਲੋ ਸਾਰਾ ਵਿੱਚ ਸਾਰਾ ਖਾਣਾ ਪੀਣਾ ਵਿੱਚ ਮਿਲਾ ਕੇ ਸਭ ਕੁਝ ਏ ਟੂ ਜੈਡ ਕਰਕੇ ਪੰਜਾਹ ਹਜ਼ਾਰ ਲਾ ਦੇਵਾਂਗੇ ਇਕੱਲਾ ਉਹ ਹਾਂਜੀ ਔਰ ਖਾਣ ਪੀਣ ਦਾ ਸਾਰਿਆਂ ਦਾ ਹਾਂਜੀ ਸਾਰਿਆਂ ਦਾ ਕਰਕੇ ਸਾਰਿਆਂ ਦਾ ਕਰਕੇ ਸਾਰਿਆਂ ਦਾ ਕਰਕੇ ਤੁਹਾਨੂੰ ਅਸੀਂ ਪੰਜਾਹ ਹਜ਼ਾਰ 'ਚ ਵਿੱਚ ਵਿੱਚ ਸਾਰਾ ਪ੍ਰੋਗਰਾਮ ਸੈੱਟ ਕਰ ਦੇਵਾਂਗੇ ਹਾਂਜੀ ਬਾਕੀ ਤੁਸੀਂ ਮੈਨੂੰ ਭਾਅ ਜੀ ਨਾ ਆਪਣੇ ਹਾਂ ਡਿਸਕਸ ਸਲਾਹ ਕਰਕੇ ਫਿਰ ਮੈਨੂੰ ਇੱਕ ਵਾਰ ਭਾਅ ਜੀ ਤੁਸੀਂ ਦੱਸ ਦਿਓ ਕਿੱਦਾਂ ਹਨਾ ਅਤੇ ਮੈਨੂੰ ਫੋਨ ਕਰ ਦਿਓ ਭਾਅ ਜੀ ਇਸੀ ਨੰਬਰ 'ਤੇ ਠੀਕ ਹੈ ਭਾਅ ਜੀ ਠੀਕ ਠੀਕ ਠੀਕ ਹੈ ਭਾਅ ਜੀ ਓਕੇ ਭਾਅ ਜੀ ਓਕ